ਸਾਡੇ ਖੇਤਰ ਵਿੱਚ ਬਾਹਲਾ ਤਾਂ ਜ਼ਿਆਦਾ ਇਹ ਚੱਲਦਾ ਵੀ ਦਸਵੀਂ ਤੋਂ ਬਾਅਦ ਪਲੱਸ ਟੂ ਕਰਦਾ ਅਗਲਾ ਪਲੱਸ ਟੂ ਤੋਂ ਬਾਅਦ ਐਲਸ ਕਰ ਲੈਂਦਾ ਐਲਸ ਕਰਕੇ ਹਰ ਇੱਕ ਦੇ ਅੱਜ ਕੱਲ੍ਹ ਮਨ ਦੇ ਵਿੱਚ ਹੈ ਵੀ ਮੈਂ ਬਾਹਰ ਜਾਵਾਂ ਬਾਹਰਲੇ ਪੜ੍ਹਾਈ ਕਰਾਂ ਜਾ ਕਰਕੇ ਉਹ ਬਾਹਰ ਪੜ੍ਹਾਈ ਵਾਸਤੇ ਐਲਸ ਕਰ ਲੈਂਦਾ ਬਾਹਰ ਚਲੇ ਜਾਂਦਾ ਪਰ ਕੁਝ ਲੋਕ ਇੱਥੇ ਰਹਿ ਕਰਕੇ ਕਿਸੇ ਨੇ ਬੀ ਟੈਕ ਕਰ ਲਈ ਡਿਪਲੋਮਾ ਕਰ ਲਿਆ ਕਿਸੇ ਨੇ ਬੀ ਏ ਕਰ ਲਈ ਕਿਉਂਕਿ ਨੌਕਰੀਆਂ ਤਾਂ ਇੱਥੇ ਸਾਡੇ ਵੀ ਬਹੁਤ ਨੇ ਕਿਸੇ ਨੇ ਮੈਡੀਕਲ ਕਰ ਲਿਆ ਕਿਸੇ ਨੇ ਨਾਨ ਮੈਡੀਕਲ ਕਰ ਲਿਆ ਕਿਸੇ ਨੇ ਬੈਂਕ ਟੈਪ ਦੇ ਪੇਪਰ ਦੇਣ ਵਾਲੇ ਆ ਰ ਰ ਰੱਖ ਲਈਆਂ ਆਪਣੀਆਂ ਅਤੇ ਕਈ ਬੱਚੇ ਐੱਮ ਏ ਕਿਉਂਕਿ ਸਾਡੇ ਯੂਨੀਵਰਸਿਟੀਆਂ ਵੀ ਨੇ ਕਈ ਕਈ ਐਗਰੀਕਲ ਕਲਚਰ ਖੇਤਰ ਵਿੱਚ ਭਾਗ ਲੈ ਲੈਂਦੇ ਯੂਨੀਵਰਸਿਟੀ ਐਗਰੀਕਲਚਰ ਵੀ ਹੈਗੀ ਹੈ ਸਾਡੇ ਪੰਜਾਬੀ ਯੂਨੀਵਰਸਿਟੀ ਵਿੱਚ ਲੈ ਕੇ ਅਡਮੀਸ਼ਨਾਂ ਉੱਥੇ ਭਾਈ ਆਪਣਾ ਐੱਮ ਏ ਐੱਮ ਫਿਲ ਤੱਕ ਕਰਦੇ ਨੇ ਪੜ੍ਹਾਈ ਉੱਚੀ ਉੱਚੀ ਤੋਂ ਉੱਚੀ ਤੱਕ ਪੜ੍ਹਾਈ ਕਰਦੇ ਨੇ ਪਰ ਜ਼ਿਆਦਾਤਰ ਬੱਚੇ ਅੱਜ ਕੱਲ੍ਹ ਇਹ ਚਲ ਹੈਗਾ ਪਲੱਸ ਟੂ ਕਰਕੇ ਬਾਹਰ ਨੂੰ ਭੱਜਣ ਦੀ ਕਰਦੇ ਆ ਵੀ ਬਾਹਰ ਪਤਾ ਨਹੀਂ ਕੀ ਸੋਨੇ ਦੀ ਖਾਣ ਆ ਇਹ ਫੇ ਇਹ ਤਾਂ ਹੁਣ ਉਸ ਉਹਨਾਂ ਦਾ ਜਮ ਦਿਮਾਗ ਹੀ ਦੱਸ ਸਕਦੇ ਨੇ ਪਰ ਕੰਮ ਜਿਸ ਨੂੰ ਕੰਮ ਦਾ ਤਰੀਕਾ ਮੈਂ ਇੱਕ ਉਸ ਰੂਪ ਵਿੱਚ ਬੋਲਾਂਗਾ ਸ਼ਬਦ ਕਿ ਜਿਸ ਨੂੰ ਇੱਥੇ ਕੰਮ ਦਾ ਤਰੀਕਾ ਆ ਜਿਹਨੂੰ ਜਿਸਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਕਿਤੇ ਜਾਣ ਦੀ ਲੋੜ ਹੀ ਨੀਗੀ ਠੀਕ ਆ ਜੀ